ਹਾਂਜੀ ਮੇਰੀ ਜ਼ੋ ਰੋਜ਼ੀ ਰੋਟੀ ਜਿਹੜੀ ਹੈਗੀ ਆ ਉਹ ਮਸ਼ੀਨਾਂ ਦੇ ਉੱਤੇ ਨਿਰਭਰ ਕਰਦੀ ਹੈ ਅਤੇ ਮਸ਼ੀਨਾਂ ਜਿਹੜੀਆਂ ਹਨ ਉਹ ਬਿਜਲੀ ਨਾਲ ਹੀ ਚੱਲਦੀਆਂ ਹਨ ਇਸੇ ਕਰਕੇ ਜਿ ਜੋ ਵੀ ਮੈਂ ਕਮਾਉਂਦਾ ਹਾਂ ਉਹ ਮਸ਼ੀਨਾਂ ਦੇ ਤੇ ਉੱਪਰ ਕੰਮ ਕਰਕੇ ਹੀ ਕਮਾਉਂਦਾ ਹਾਂ

ਅਜਿਹਾ ਯੁਗ ਚੱਲ ਰਿਹਾ ਕਿ ਜਦੋਂ ਬਿਜਲੀ ਦਾ ਕੱਟ ਲੱਗ ਜਾਂਦੇ ਹਨ ਉਸ ਦੌਰਾਨ ਅਸੀਂ ਕੀ ਕਰੀਏ ਤਾਂ ਉਸ ਦੌਰਾਨ ਸਾਡੇ ਕੋਲ ਜਨਰੇਟਰ ਹੁੰਦੇ ਹਨ ਅਸੀਂ ਉਹ ਜਨਰੇਟਰ ਚਲਾ ਕੇ ਅਤੇ ਫਿਰ ਆਪਣਾ ਬਿਜਲੀ ਦਾ ਜਿਹੜੀ ਪੂਰਤੀ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਕੰਮ ਕਰੀਦਾ ਹੈ ਬਿਜਲੀ ਕੱਟ ਲੱਗਣ ਤੋਂ ਬਾਅਦ ਰੋਸ਼ਨੀ ਦਾ ਹੋਰ ਕੀ ਵਿਕਲਪ ਹੈ ਇੱਕ ਤਾਂ ਸਾਡੇ ਕੋਲ ਇਨਵਰਟਰ ਹੁੰਦੇ ਹਨ ਅੱਜ ਕੱਲ੍ਹ ਹਰ ਘਰ ਦੀ ਵੀ ਜ਼ਰੂਰਤ ਹੈ ਇਨਵਰਟਰ ਹੈ ਅਤੇ ਉਸ ਇਨਵਰਟਰ ਦੇ ਨਾਲ ਹੀ ਅਸੀਂ ਬਾਕੀ ਦੇ ਬਲਬ ਟਿਊਬਾਂ ਪੱਖੇ ਵਗੈਰਾ ਉੱਥੇ ਚਲਾ ਲੈਂਦੇ ਹਾਂ ਲੇਕਿਨ ਮਸ਼ੀਨ ਜਿਹੜੀ ਹੈ ਉਹ ਵੱਡੀ ਹੁੰਦੀ ਹੈ ਉਹ ਉਹਦੇ ਵਾਸਤੇ ਸਾਨੂੰ ਜਨਰੇਟਰ ਹੀ ਚਲਾਉਣੇ ਪੈਂਦੇ ਹਨ ਅਤੇ ਇਸ ਲਈਏ ਅੱਜ ਕੱਲ੍ਹ ਹਰ ਘਰ ਦੇ ਵਿੱਚ ਲੋਕਾਂ ਕੋਲ ਇਨਵਰਟਰ ਹੁੰਦਾ ਹੈ ਅਤੇ ਇਨਵਰਟਰ ਮੇਨ ਰੂਪ 'ਤੇ ਉਹਨਾਂ ਦੀ ਮੇਨ ਜ਼ਰੂਰਤ ਬਣ ਚੁੱਕੀ ਹੈ ਬਿਜਲੀ ਹੋਵੇਗੀ ਤਾਂ ਹੀ ਸਾਡਾ ਅੱਗੇ ਸਾਰੇ ਜਿਹੜਾ ਹੈ ਅੱਜ ਕੱਲ੍ਹ ਸਭ ਕੁਛ ਚੱਲ ਸਕਦਾ ਹੈ ਨਹੀਂ ਤਾਂ ਉਸ ਦੇ ਦੌਰਾਨ ਅਸੀਂ ਬਿਲਕੁਲ ਇਕਦਮ ਹੀ ਖਾਲੀ ਹੋਣ ਵਾਲਾ ਹਿਸਾਬ ਹੋ ਜਾਂਦਾ ਹੈ ਵਿਹਲੇ ਹੋਣ ਵਾਲਾ ਹਿਸਾਬ ਹੋ ਜਾਂਦਾ ਹੈ